ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਬਰ ਵਾਲ਼ੇ ਤੋਂ ਬੋਲ ਰਹੇ ਹੋ ਜੀ ਮੈਨੂੰ ਨਾ ਉਹਦਾ ਰੇਟ ਦੱਸੋ ਅਸੀਂ ਚਾਰ ਜਣਿਆਂ ਨੇ ਚੰਡੀਗੜ੍ਹ ਜਾਣਾ ਕਿ ਇਨੋਵਾ ਦਾ ਕੀ ਰੇਟ ਆ ਜੇ ਛੇ ਜਣੇ ਹੋ ਗਏ ਅਤੇ ਚਾਰ ਜਣੇ ਹਾਂ ਤਾਂ ਆਲਟੋ ਦਾ ਕੀ ਰੇਟ ਆ ਔਰ ਸਵਿਫਟਜ ਕਿੰਨੇ 'ਚ ਪੈ ਜੂਗੀ ਅਸੀਂ ਛੇ ਜਣੇ ਹੋ ਸਕਦੇ ਹਾਂ ਔਰ ਉੱਥੇ ਸ਼ੋਪਿੰਗ ਕਰਨ ਜਾਣਾ ਕਿੰਨੇ 'ਚ ਪੈ ਜੂੰਗੇ ਕਿ ਇਹਨਾਂ ਦੇ ਤਿੰਨਾਂ ਦੇ ਰ ਗੱਡੀਆਂ ਦੇ ਰੇਟ ਦੱਸੋ ਅਲੱਗ ਅਲੱਗ